ਸਕੂਲ ਵਿੱਚ ਸਭ ਤੋਂ ਜ਼ਿਆਦਾ ਮੇਰਾ ਮਨਪਸੰਦ ਵਿਸ਼ਾ ਕੈਮਿਸਟਰੀ ਸੀ ਅਤੇ ਮੈਨੂੰ ਉਹ ਵਿਸ਼ਾ ਇਸ ਕਰਕੇ ਪਸੰਦ ਸੀ ਕਿਉਂਕਿ ਮੇਰੀ ਰੁਚੀ ਬਚਪਨ ਤੋਂ ਹੀ ਇੱਕ ਰਿਸਰਚ ਪ੍ਰੋਫੈਸਰ ਬਣਨ ਦੀ ਸੀ ਮੈਂ ਹਮੇਸ਼ਾ ਤੋਂ ਚਾਹੁੰਦੀ ਸੀ ਕਿ ਮੈਂ ਚੀਜ਼ਾਂ ਬਾਰੇ ਦੇਖਾਂ ਉਹਨੂੰ ਸਮਝਾ ਅਤੇ ਉਹਦੇ ਬਾਰੇ ਅੱਗੇ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂ ਕੈਮਿਸਟਰੀ ਵਿੱਚ ਮੈਂ ਐਟਮਸ ਬਾਰੇ ਪੜ੍ਹਿਆ ਜੋ ਮੈਨੂੰ ਬਹੁਤ ਹੀ ਜ਼ਿਆਦਾ ਰੁਚੀਵਾਨ ਲੱਗਿਆ ਫਿਰ ਮੈਂ ਅੱਗੇ ਉਹਦੇ ਬਾਰੇ ਹੋਰ ਪੜ੍ਹਿਆ ਕਿਹੜੇ ਕਿਹੜੇ ਵੱਡੇ ਵੱਡੇ ਵਿਗਿਆਨਿਕ ਸੀ ਜਿਨ੍ਹਾਂ ਨੇ ਉਹਨਾਂ ਦੀ ਖੋਜ ਕੀਤੀ ਅਤੇ ਅੱਗੇ ਵੀ ਐਟਮ ਨੂੰ ਕਿੰਨੇ ਹੋਰ ਪਾਰਟਸ ਵਿੱਚ ਅਸੀਂ ਵੰਡ ਸਕਦੇ ਹਨ ਮੈਂ ਉਹਦੇ ਬਾਰੇ ਅੱਗੇ ਪੜ੍ਹਿਆ ਰਿਸਰਚ ਕੀਤੀ ਅਤੇ ਉਸ ਤੋਂ ਬਾਅਦ ਜਦ ਮੈਂ ਵੱਡੀ ਕਲਾਸ ਵਿੱਚ ਹੋਈ ਤਾਂ ਕਰਕੇ ਮੈਨੂੰ ਲੈਬ ਵਗੈਰਾ ਜਾਣ ਦੀ ਅਨੁਮਤੀ ਵੀ ਦਿੱਤੀ ਗਈ ਫਿਰ ਜਦ ਮੈਂ ਲੈਬ 'ਚ ਜਾ ਕੇ ਮਾਈਕਰੋਸਕੋਪ ਦੇ ਅੰਡਰ ਸਾਰੀ ਚੀਜ਼ਾਂ ਨੂੰ ਦੇਖਿਆ ਓਬਜਰਵ ਕਰਿਆ ਤਾਂ ਮੇਰੀ ਰੁਚੀ ਇਸ ਛੇਤਰ ਵਿੱਚ ਹੋਰ ਜ਼ਿਆਦਾ ਵੱਧ ਗਈ ਮੈਨੂੰ ਆਹ ਸਭ ਕਰਨਾ ਲਾਈਕ ਰਿਸਰਚ ਕਰਨੀ ਉਹ ਸਭ ਜ਼ਿਆਦਾ ਪਸੰਦ ਸੀ ਤਾਂ ਕਰਕੇ ਜਦ ਮੈਂ ਇਹਨੂੰ ਹੋਰ ਅੱਗੇ ਵਧਾਇਆ ਆਪਣੇ ਜੀਵਨ ਵਿੱਚ ਉਹਨੇ ਮੇਰੀ ਅਸਲ ਵਿੱਚ ਜੀਵਨ ਵਿੱਚ ਹੋਰ ਮਦਦ ਕੀਤੀ ਅਤੇ ਮੇਰੇ ਅੱਗੇ ਫਿਊਚਰ ਬਣਾਉਣ ਦੀ ਵੀ ਕੋਸ਼ਿਸ਼ ਕੀਤੀ